ਸਾਡੇ ਸਕੂਲ ਵਿੱਚ ਬਹੁਤ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਇੱਕ ਇੱਕ ਸਾਲ ਵਿੱਚ ਇੱਕ ਸਾਲ ਸਾਡੇ ਸਕੂਲ ਵਿੱਚ ਪੇਂਟਿੰਗ ਦਾ ਮੁਕਾਬਲਾ ਹੋਇਆ ਜਿਸ ਵਿੱਚ ਮੈਂ ਵੀ ਭਾਗ ਲਿਆ ਮੈਂ ਬਹੁਤ ਪੇਂਟਿੰਗ ਦਾ ਬਹੁਤ ਮਾਹਰ ਤਾਂ ਨਹੀਂ ਸੀ ਪਰ ਫਿਰ ਵੀ ਮੈਂ ਇਸ ਵਿੱਚ ਭਾਗ ਲਿਆ ਅਧਿਆਪਕ ਸਹਿਬਾਨ ਨੇ ਸਾਨੂੰ ਇੱਕ ਚਰਿੱਤ ਚਰਿੱਤਰ ਦਾ ਟਾਸਕ ਦਿੱਤਾ ਜਿਸ ਨੂੰ ਮੈਂ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਅਤੇ ਕਾਫ਼ੀ ਹੱਦ ਤੱਕ ਵਧੀਆ ਬਣਾਇਆ ਅਤੇ ਜਿਸ ਦਾ ਮੈਨੂੰ ਤੀਜਾ ਮੇਰਾ ਸਥਾਨ ਮੈਂ ਪ੍ਰਾਪਤ ਕੀਤਾ ਅਤੇ ਸਥਾਨ ਵਿੱਚ ਮੈਨੂੰ ਉਸ ਵਜੋਂ ਮੈਨੂੰ ਇਨਾਮ ਤਾਂ ਨਹੀਂ ਮਿਲਿਆ ਪਰ ਇੱਕ ਸਰਟੀਫ਼ਿਕੇਟ ਮਿਲਿਆ ਜਿਸ ਵਿੱਚ ਮੇਰੀ ਸ਼ਲਾਘਾ ਕੀਤੀ ਗਈ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਮੈਂ ਚਾਹੁੰਦਾ ਕਿ ਬਾਕੀ ਵੀ ਮੈਂ ਇਸ ਤੋਂ ਬਾਅਦ ਮੈਂ ਹੋਰ ਵੀ ਕਈ ਮੁ ਮੁਕਾਬਲਿਆਂ ਵਿੱਚ ਭਾਗ ਲਿਆ